ਮੈਨੂੰ ਜ਼ਿਆਦਾਤਰ ਕਿਤਾਬਾਂ ਪੜ੍ਹਨ ਦਾ ਇੰਨਾ ਸ਼ੌਕ ਤਾਂ ਨਹੀਂ ਹੈ ਪਰ ਜਦੋਂ ਮੇਰਾ ਬਰਡੇ ਸੀ ਤਾਂ ਮੇਰੇ ਇੱਕ ਫਰੈਂਡ ਨੇ ਮੈਨੂੰ ਇੱਕ ਕਿਤਾਬ ਗਿਫ਼ਟ ਕੀਤੀ ਸੀ ਪਹਿਲਾਂ ਤਾਂ ਮੈਨੇ ਉਹ ਗਿਫ਼ਟ ਨਹੀਂ ਖੋਲ੍ਹਿਆ ਮੈਨੂੰ ਨਹੀਂ ਪਤਾ ਸੀ ਕਿ ਉਸ ਵਿੱਚ ਇੱਕ ਕਿਤਾਬ ਹੈ ਜਦੋਂ ਮੈਂ ਇੱਕ ਵਾਰ ਐਵੇਂ ਹੀ ਬੈਠੀ ਹੋਈ ਸੀ ਤਾਂ ਮੈਨੇ ਦੇਖਿਆ ਕਿ ਉਹ ਗਿਫ਼ਟ ਪਿਆ ਹੈ ਅਤੇ ਮੈਂ ਉਹਨੂੰ ਖੋਲ੍ਹਣ ਲੱਗ ਪਈ ਅਤੇ ਮੈਨੇ ਦੇਖਿਆ ਕਿ ਉਸ ਵਿੱਚ ਇੱਕ ਕਿਤਾਬ ਹੈ ਜਿਹੜੀ ਕਿ ਸੀ ਰਿੱਚ ਡੈਡ ਅਤੇ ਪੂਅਰ ਡੈਡ ਦੀ ਅਤੇ ਇਸ ਵਿੱਚ ਇੱਕ ਸਟੋਰੀ ਹੈ ਬਹੁਤ ਵਧੀਆ ਅਤੇ ਪਹਿਲਾਂ ਜਦੋਂ ਮੈਂ ਉਸ ਕਿਤਾਬ ਨੂੰ ਪੜ੍ਹਿਆ ਤਾਂ ਮੈਨੂੰ ਜ਼ਿਆਦਾ ਕੁਝ ਇਹ ਕਿਤਾਬ ਵਧੀਆ ਤਾਂ ਨਹੀਂ ਲੱਗੀ ਪਰ ਮੈਨੇ ਸੋਚਿਆ ਕਿ ਨਹੀਂ ਹੁਣ ਮੈਂ ਇਹ ਕਿਤਾਬ ਨੂੰ ਪੂਰਾ ਕਰਕੇ ਰਹਾਂਗੀ ਜਦੋਂ ਫਿਰ ਮੈਨੇ ਅੱਗੇ ਅੱਗੇ ਇਸਨੂੰ ਪੜ੍ਹਿਆ ਤਾਂ ਮੈਨੂੰ ਇਹ ਬਹੁਤ ਹੀ ਜ਼ਿਆਦਾ ਇਸ ਵਿੱਚ ਇੰਟਰਸਟ ਆ ਗਿਆ ਅਤੇ ਮੈਨੇ ਇਹ ਕਿਤਾਬ ਸਾਰੀ ਪੜ੍ਹੀ ਅਤੇ ਇਸ ਬਹੁਤ ਹੀ ਜ਼ਿਆਦਾ ਮੈਨੂੰ ਇਹ ਵਧੀਆ ਲੱਗੀ ਇਹਦੇ ਵਿੱਚ ਬਹੁਤ ਹੀ ਵਧੀਆ ਮੈਸਿਜ ਦਿੱਤੇ ਹੋਏ ਸੀ ਬਹੁਤ ਹੀ ਜ਼ਿਆਦਾ ਵਧੀਆ ਦੱਸਿਆ ਹੋਇਆ ਸੀ ਵੀ ਕਿਵੇਂ ਆਪਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਕਿਵੇਂ ਅਮੀਰ ਤੋਂ ਗ਼ਰੀਬ ਗ਼ਰੀਬ ਤੋਂ ਅਮੀਰ ਬਣਨਾ ਚਾਹੀਦਾ ਹੈ ਕਿਵੇਂ ਸਾਰਾ ਕੁਛ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਕਦੇ ਵੀ ਗਿਵ ਅੱਪ ਨਹੀਂ ਕਰਨਾ ਚਾਹੀਦਾ ਅਤੇ ਜ਼ਿੰਦਗੀ ਨੂੰ ਬਹੁਤ ਹੀ ਚੰਗੇ ਢੰਗ ਨਾਲ਼ ਜੀਣ ਦਾ ਇਸ ਵਿੱਚ ਬਹੁਤ ਸੋਹਣਾ ਮੈਸਿਜ ਦਿੱਤਾ ਗਿਆ ਇਸ ਵਿੱਚ ਇੱਕ ਮੈਸਿਜ ਹੈ ਜੋ ਲਾਈਨ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਉਹ ਹੈ ਕਿ ਗ਼ਰੀਬ ਪੈਦਾ ਹੋਣਾ ਸਾਡੀ ਗਲਤੀ ਨਹੀਂ ਗ਼ਰੀਬ ਮਰਨਾ ਸਾਡੀ ਗਲਤੀ ਹੈ ਇਸ ਵਿੱਚ ਇੱਕ ਫਾਦਰ ਆਪਣੇ ਸੰਨ ਨੂੰ ਇਹ ਚੀਜ਼ ਸਮਝਾਉਂਦਾ ਹੈ ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜਾ ਉਹ ਸੰਨ ਹੈ ਉਹ ਆਪਣੇ ਫਾਦਰ ਦੀ ਕੁਝ ਵੀ ਨਹੀਂ ਸੁਣਦਾ ਹੁੰਦਾ ਉਸਦਾ ਕੋਈ ਹੁਣ ਕਦਰ ਨਹੀਂ ਕਰਦਾ ਹੁੰਦਾ ਆਪਣੇ ਫਾਦਰ ਦੀ ਪਰ ਜਦੋਂ ਉਹਦਾ ਫਾਦਰ ਬਿਮਾਰ ਹੋ ਜਾਂਦਾ ਹੈ ਜਦੋਂ ਮਰਨ ਦੀ ਕਗਾਰ 'ਤੇ ਪਿਆ ਹੁੰਦਾ ਹੈ ਤਾਂ ਉਸਨੂੰ ਸਮਝ ਆਉਂਦਾ ਹੈ ਕਿ ਨਹੀਂ ਵੀ ਫਾਦਰ ਤੋਂ ਬਿਨਾ ਜ਼ਿੰਦਗੀ ਕੁਛ ਨਹੀਂ ਹੋ ਸਕਦੀ ਅਤੇ ਉਹ ਆਪਣੇ ਉਸ ਟਾਈਮ ਵਿੱਚ ਫਾਦਰ ਆਪਣੇ ਜਿਹੜੇ ਆਪਣੇ ਸੰਨ ਨੂੰ ਇਹ ਚੀਜ਼ ਸਮਝਾਉਂਦਾ ਹੈ ਕਿ ਕਦੇ ਵੀ ਜ਼ਿੰਦਗੀ ਵਿੱਚ ਕਦੇ ਹਾਰ ਨਾ ਮੰਨੋ ਆਪਣੇ ਮਾਂ ਬਾਪ ਦੀ ਹਮੇਸ਼ਾ ਇੱਜਤ ਕਰੋ ਕਿਉਂਕਿ ਜਿਹੜੇ ਮਾਂ ਬਾਪ ਆ ਜ਼ਿੰਦਗੀ 'ਚ ਸਿਰਫ਼ ਇੱਕ ਵਾਰ ਹੀ ਮਿਲਦੇ ਨੇ ਅਤੇ ਵਾਰ ਵਾਰ ਨਹੀਂ ਮਿਲਦੇ ਜ਼ਿੰਦਗੀ ਵੀ ਸਿਰਫ਼ ਆਪਾਂ ਨੂੰ ਇੱਕ ਹੀ ਵਾਰ ਮਿਲਦੀ ਹੈ ਇਸਨੂੰ ਵਧੀਆ ਤਰੀਕੇ ਨਾਲ਼ ਜੀਓ ਕਦੇ ਕਿਸੇ ਨਾਲ਼ ਬੇਇਮਾਨੀ ਨਾ ਕਰੋ ਕਦੇ ਕਿਸੇ ਨੂੰ ਧੋਖਾ ਨਾ ਦਿਉ ਅਤੇ ਮੈਨੂੰ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਅਤੇ ਮੇਰੇ ਦਿਲ ਵਿੱਚ ਇਸਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਮੇਰੇ ਮਨ ਉੱਪਰ ਅਤੇ ਇੱਕ ਵਕਤ 'ਤੇ ਤਾਂ ਮੇਰਾ ਕਿਤਾਬ ਪੜ੍ਹ ਕੇ ਰੋਣਾ ਵੀ ਆ ਗਿਆ ਸੀ ਅਤੇ ਬਹੁਤ ਹੀ ਜ਼ਿਆਦਾ ਮੈਨੂੰ ਇਹ ਕਿਤਾਬ ਵਧੀਆ ਲੱਗੀ ਅਤੇ ਮੈਂ ਬਹੁਤ ਹੀ ਜ਼ਿਆਦਾ ਮੇਰੇ ਫਰੈਂਡ ਦਾ ਮੈਂ ਥੈਂਕ ਯੂ ਕਰਦੀ ਹਾਂ ਜਿਸਨੇ ਮੈਨੂੰ ਇਹ ਕਿਤਾਬ ਗਿਫ਼ਟ ਕੀਤੀ ਅਤੇ ਮੈਂ ਬਹੁਤ ਜ਼ਿਆਦਾ ਉਹਦੀ ਧੰਨਵਾਦ ਹਾਂ